ਮੈਂ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਨਾ ਪਸੰਦ ਨਹੀਂ ਕਰਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਕੀ ਮੇਰੀ ਤਸਵੀਰ ਹਰ ਕੋਈ ਦੇਖੇ ਅਤੇ ਇਸ ਦਾ ਕੋਈ ਗਲਤ ਉਪਯੋਗ ਕਰੇ ਜਾਂ ਇਸ 'ਤੇ ਕੋਈ ਗਲਤ ਕਮੈਂਟ ਕਰੇ ਮੈਂ ਆਪਣੀਆਂ ਤਸਵੀਰਾਂ ਸਿਰਫ ਆਪਣੇ ਫਰੈਂਡਸ ਜਾਂ ਰਿਲੇਟਿਵਸ ਨਾਲ ਹੀ ਸ਼ੇਅਰ ਕਰਦੀ ਹਾਂ ਇਸ ਨਾਲ ਮੈਨੂੰ ਇੱਕ ਪ੍ਰਾਈਵੇਸੀ ਮਿਲਦੀ ਹੈ ਅਤੇ ਮੈਂ ਇਹ ਵੀ ਯਕੀਨੀ ਬਣਾਉਂਦੀ ਹਾਂ ਕਿ ਮੇਰੀ ਤਸਵੀਰ ਕਿਸੇ ਗਲਤ ਹੱਥਾਂ ਵਿੱਚ ਨਾ ਆਵੇ ਕਿਉਂਕੀ ਅੱਜ ਸੋਸ਼ਲ ਮੀਡੀਆ ਦੇ ਸਮੇਂ ਵਿੱਚ ਜਿੱਥੇ ਸੋਸ਼ਲ ਮੀਡੀਆ ਦੇ ਲਾਭ ਹਨ ਉੱਥੇ ਹਾਨੀਆਂ ਵੀ ਮੌਜੂਦ ਹਨ ਅੱਜ ਦੇ ਸਮੇਂ ਵਿੱਚ ਅਜਿਹੇ ਬਹੁਤ ਲੋਕ ਹਨ ਜੋ ਸੋਸ਼ਲ ਮੀਡੀਆ ਤੋਂ ਤਸਵੀਰਾਂ ਚੱਕ ਕੇ ਇਸ ਦਾ ਗਲਤ ਉਪਯੋਗ ਕਰਦੇ ਹਨ ਜਾਂ ਫਿਰ ਬਲੈਕਮੇਲ ਕਰਦੇ ਹਨ ਮੈਂ ਆਪਣੀਆਂ ਤਸਵੀਰਾਂ ਵਟਸਐਪ ਰਾਹੀਂ ਫਰੈਂਡਸ ਨਾਲ ਜਾਂ ਰਿਲੇਟਿਵਸ ਨਾਲ ਸ਼ੇਅਰ ਕਰਦੀ ਹਾਂ ਜਿਸ ਨਾਲ ਉਸ ਵਿਅਕਤੀ ਨੂੰ ਹੀ ਮੇਰੀ ਤਸਵੀਰ ਸਾਂਝੀ ਹੁੰਦੀ ਹੈ ਜਿਸ ਨਾਲ ਮੈਂ ਕਰਨਾ ਚਾਹੁੰਦੀ ਹਾਂ ਇਸ ਨਾਲ ਮੈਨੂੰ ਇੱਕ ਪ੍ਰਾਈਵੇਸੀ ਮਿਲਦੀ ਹੈ ਕਿ ਮੇਰੀ ਤਸਵੀਰ ਕਿਸੇ ਗਲਤ ਵਿਅਕਤੀ ਕੋਲ ਨਾ ਪਹੁੰਚੇ ਮੈਂ ਸੋਸ਼ਲ ਮੀਡੀਆ ਦੇ ਵਟਸਐਪ ਐਪ ਹੀ ਯੂਜ ਕਰਦੀ ਹਾਂ ਅੱਜ ਦੇ ਸਮੇਂ ਵਿੱਚ ਬਹੁਤ ਲੋਕ ਇੰਸਟਾਗ੍ਰਾਮ ਵਰਗੇ ਐਪਸ ਅਤੇ ਫੇਸਬੁੱਕ ਵਰਗੇ ਐਪਸ ਯੂਜ ਕਰਦੇ ਹਨ ਜਿਹਨਾਂ 'ਤੇ ਉਹ ਆਪਣੀਆਂ ਪੋਸਟ ਪਾਉਂਦੇ ਹਨ ਜਿਸ ਵਿੱਚ ਉਹਨਾਂ ਦੀਆਂ ਤਸਵੀਰਾਂ ਵੀਡੀਓਜ ਆਦਿ ਸ਼ਾਮਿਲ ਹੁੰਦੀਆਂ ਹਨ ਪਰੰਤੂ ਮੈਨੂੰ ਇਹ ਸਭ ਪਸੰਦ ਨਹੀਂ ਹੈ ਸੋ ਇਸ ਲਈ ਮੈਂ ਕਿਸੇ ਸੋਸ਼ਲ ਮੀਡੀਆ ਐਪ 'ਤੇ ਆਪਣੀ ਤਸਵੀਰ ਪੋਸਟ ਕਰਨਾ ਪਸੰਦ ਨਹੀਂ ਕਰਦੀ ਧੰਨਵਾਦ